ਸਾਡੇ ਸਟੇਟ ਟਰਾਂਸਪੋਰਟ ਦੀ ਕੁਆਲਿਟੀ ਮੈਂ ਕਹਾਂਗਾ ਕਿ ਠੀਕ ਠਾਕ ਹੈ ਮਤਲਬ ਬਹੁਤ ਮਾੜੀ ਵੀ ਨਹੀਂ ਹੈ ਬਟ ਬਹੁਤ ਚੰਗੀ ਵੀ ਨਹੀਂ ਹੈ ਦੋਨੋਂ ਪਹਿਲੂ ਹਨ ਕਿ ਚੰਗੀ ਇਸ ਲਈ ਨਹੀਂ ਹੈ ਕਿਉਂਕਿ ਕਾਫ਼ੀ ਦੇਰ ਤੋਂ ਕੋਈ ਨਵੇਂ ਨਵੇਂ ਟਰਾਂਸਪੋਰਟ ਅਪਡੇਟ ਨਹੀਂ ਹੋਇਆ ਜੋ ਪੁਰਾਣੀਆਂ ਬੱਸਾਂ ਪੁਰਾਣੀ ਟ੍ਰੇਨਸ ਚੱਲਦੀਆਂ ਹਨ ਟ੍ਰੇਨਾਂ 'ਚ ਫਿਰ ਵੀ ਆਇਆ ਬੱਸਾਂ ਲੋਕਲ ਕਹਿ ਲਓ ਜਾਂ ਲੋਕਲ ਟ੍ਰੇਨਸ ਕਹਿ ਲਓ ਉਹਨਾਂ 'ਚ ਨਹੀਂ ਆਇਆ ਬਦਲਾਅ ਜ਼ਿਆਦਾ ਜੋ ਪੁਰਾਣੀਆਂ ਚੱਲਦੀਆਂ ਆਰਨ ਆ ਰਹੀਆਂ ਹਨ ਉਹ ਹੀ ਚੱਲੀ ਜਾ ਰਹੀਆਂ ਹਨ ਕੁਛ ਕੁਛ ਮੇਟੀਨੈਂਸ ਹੁੰਦੀ ਰਹਿੰਦੀ ਹੈ ਬਟ ਫਿਰ ਵੀ ਕੁਛ ਨਵਾਂ ਕੁਛ ਅਪਡੇਟ ਨਹੀਂ ਆਇਆ ਬਟ ਜੋ ਹਾਲਾਤ ਹੈ ਬੱਸਾਂ ਦੇ ਉਹ ਚਲੋ ਫਿਰ ਵੀ ਠੀਕ ਹੈ ਕਿ ਕੰਮ ਕਰ ਰਹੇ ਹਨ ਸਰਕਾਰ ਵੱਲੋਂ ਕਈ ਔਫਰ ਵੀ ਹਨ ਲੇਡੀਜ ਨੂੰ ਕਈ ਲੋਕਲ ਰਹਿਣ ਵਾਲੀਆਂ ਔਰਤਾਂ ਲਈ ਕਈ ਮੁਫ਼ਤ ਵੀ ਹਨ ਟਰੈਵਲ ਕਰਨਾ ਅਤੇ ਇੱਦਾਂ ਸਹੂਲਤਾਂ ਤਾਂ ਹਨ ਜਿਸ ਲਈ ਮੈਂ ਕਹਾਂਗਾ ਕਿ ਠੀਕ ਠਾਕ ਹੈ ਕੁਆਲਿਟੀ ਬਾਕੀ ਭਾਰਤ ਵਿੱਚ ਯਾਤਰਾ ਕਰਨਾ ਬਿਲਕੁਲ ਕਿਫਾਇਤੀ ਹੈ ਕਈ ਮਤਲਬ ਟਰੇਨ ਬੱਸਾਂ ਕਈ ਓਪਸ਼ਨਾਂ ਹਨ ਅੱਜ ਕੱਲ੍ਹ ਤਾਂ ਫਲਾਈਟਸ ਵੀ ਕਾਫ਼ੀ ਠੀਕ ਪ੍ਰਾਈਸ 'ਚ ਮਿਲ ਜਾਂਦੀਆਂ ਹਨ ਇਕਨੋਮਿਕ ਹੋ ਗਈਆਂ ਅਤੇ ਕਈ ਦੇਸ਼ਾਂ ਨਾਲੋਂ ਭਾਰਤ 'ਚ ਯਾਤਰਾ ਕਰਨਾ ਕਿਫਾਇਤੀ ਹੈ